ਹੈਲੋ ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ ਬੋਲ ਰਹੇ ਹੋ ਹਾਂਜੀ ਉਹ ਮੈਂ ਮਨੀਸ਼ਾ ਬੋਲ ਰਹੀ ਹਾਂ ਹਾਂਜੀ ਹਾਂਜੀ ਹੋਰ ਕੀ ਹਾਲ ਚਾਲ ਹੋਰ ਕੀ ਹਾਲ ਚਾਲ ਕੀ ਕਰਦੇ ਪਏ ਹੋ ਮੈਂ ਐਕਚੁਲੀ ਮੈਂ ਅੱਜ ਕੱਲ੍ਹ ਬਾਹਰ ਰਹਿ ਰਹੀ ਹਾਂ ਹਾਂਜੀ ਅਤੇ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਠੀਕ ਮੈਂ ਨਾ ਐਕਚੁਲੀ ਪੁੱਛਣਾ ਸੀਗਾ ਕਿ ਤੁਹਾਡੇ ਉੱਥੇ ਅ ਪਾਕਿਸਤਾਨ ਕਿੰਨਾ ਕੁ ਦੂਰ ਹੋਏਗਾ ਤੁਹਾਡੇ ਤੋਂ ਠੀਕ ਹੈ ਠੀਕ ਹੈ ਅਤੇ ਅਗਰ ਮੈਂ ਪਾਕਿਸਤਾਨ ਜਾਣਾ ਹੋਵੇ ਤਾਂ ਮੈਂ ਕਿਵੇਂ ਜਾ ਸਕਦੀ ਹਾਂ ਉੱਥੇ ਹਾਂਜੀ ਹਾਂਜੀ ਪਾਸਪੋਰਟ ਹੈ ਠੀਕ ਹੈ ਅਤੇ ਮੈਨੂੰ ਉੱਥੇ ਦਿੱਲੀ ਜਾ ਕੇ ਲਗਵਾਉਣਾ ਪਏਗਾ ਠੀਕ ਹੈ ਓਕੇ ਅਤੇ ਤੁਸੀਂ ਫਿਰ ਮੈਨੂੰ ਪਤਾ ਕਰਕੇ ਦੱਸ ਸਕਦੇ ਹੋ ਪੂਰੀ ਨੌਲੇਜਿਸ ਇਸ ਬਾਰੇ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਠੀ ਹਾਂਜੀ ਮੈਂ ਐਕਚੁਲੀ ਮੈਂ ਸ਼ਾਮ ਨੂੰ ਹੀ ਫਰੀ ਹੁੰਦੀ ਹਾਂ ਕਿਉਂਕਿ ਦਿਨੇ ਮੈਂ ਡਿਊਟੀ 'ਤੇ ਹੁੰਦੀ ਹਾਂ ਹਾਂਜੀ ਠੀਕ ਹੈ ਓਕੇ ਥੈਂਕ ਯੂ